ਹੈਲੋ ਸਤਿ ਸ਼੍ਰੀ ਅਕਾਲ ਸਰ ਅਸੀਂ ਸੰਧੂ ਤੋਂ ਬੋਲ ਰਹੇ ਹਾਂ ਹਾਂਜੀ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਹਾਂਜੀ ਸਰ ਸਾਡੇ ਸਾਡੇ ਸਟੋਰੀ ਦਾ ਹੀ ਭੁੱਗਾ ਅਤੇ ਖਜੂਰਾਂ ਹਨ ਹਾਂਜੀ ਤੁਸੀਂ ਦੱਸੋ ਕਿ ਤੁਹਾਨੂੰ ਕਿਨ ਕਿਸ ਕੁਆਂਟਿਟੀ ਦੇ ਵਿੱਚ ਚਾਹੀਦੀਆਂ ਨੇ ਤਾਂ ਤਾਂਕਿ ਅਸੀਂ ਉਸ ਉਸ ਤਰੀਕੇ ਨਾਲ ਤੁਹਾਨੂੰ ਉਸ ਕਿਸ ਦਿਨ ਅਸੀਂ ਆਰਡਰ ਪਹੁੰਚਾ ਸਕਦੇ ਹਾਂ ਅਤੇ ਉਸਦੇ ਕੀ ਚਾਰਜਸ ਰਹਿਣਗੇ ਅਸੀਂ ਤੁਹਾਨੂੰ ਉਸ ਉਸ ਬਾਰੇ ਸਿੱਖੀਏ

ਠੀਕ ਹੈ ਸਰ ਜਿਵੇਂ ਕਿ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਭੁੱਗਾ ਪੰਜ ਸੌ ਰੁਪਏ ਕਿਲੋ ਹੁੰਦਾ ਆ ਅਤੇ ਖਜੂਰਾਂ ਚਾਰ ਸੌ ਰੁਪਏ ਕਿਲੋ ਹੁੰਦੀਆਂ ਨੇ ਜਿਵੇਂ ਕਿ ਤੁਸੀਂ ਸੁਣਿਆ ਹੀ ਹੋਇਆ ਕਿ ਸਾਡੇ ਸਾਡੀ ਸਪੈਸ਼ੈਲਿਟੀ ਹੀ ਇਹ ਹੈ ਅਤੇ ਇਹ ਅਸੀਂ ਸਪੈਸ਼ਲ ਲੋਹੜੀ ਦੇ ਲਈ ਹੀ ਬਣਾਉਂਦੇ ਹਾਂ ਨਾਲੇ ਇਹ ਅਸੀਂ ਦੇਸੀ ਘਿਓ ਦੇ ਵਿੱਚ ਪਿਓਰ ਪਿਓਰ ਕੰਮ ਕਰੀਦਾ ਵਾ ਸਾਡੇ ਕੋਈ ਇੱਦਾਂ ਦਾ ਕੰਮ ਨਹੀਂ ਹੈਗਾ ਇਸ ਲਈ ਇਸਦੇ ਕਾਫੀ ਜਿਆਦਾ ਚਾਰਜਿਜ ਹੋ ਜਾਣਗੇ ਅਤੇ ਇਸ ਦੀ ਡਿਲੀਵਰੀ ਨਹੀਂ ਅਸੀਂ ਕਰ ਪਾਵਾਂਗੇ ਕਿਉਂਕਿ ਸਾਡੇ ਇੱਥੇ ਸਰਵਿਸ ਨਹੀਂ ਅਵੇਲੇਬਲ ਹੋਏਗੀ ਠੀਕ ਹੈ ਸਰ ਪਰ ਉਹਦੇ ਉਹਦੇ ਠੀਕ ਹੈ ਸਰ ਹਾਂਜੀ ਸਰ ਕੋਈ ਗੱਲ ਨਹੀਂ ਅਸੀਂ ਮੈਂ ਕੋਸ਼ਿਸ਼ ਕਰੂੰਗੀ ਅਸੀਂ ਆਪਦੇ ਮੈਨੇਜਰ ਨਾਲ ਗੱਲ ਕਰਾਂਗੇ ਅਤੇ ਫਿਰ ਤੁਹਾਨੂੰ ਦੱਸ ਦਿਆਂਗੇ ਕਿ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਅਤੇ ਹੋਰ ਹੋਰ ਤਾਂ ਕੋਈ ਗੱਲ ਨਹੀਂ ਆ ਵੈਸੇ ਤੁਹਾਨੂੰ ਅਡੀਸ਼ਨਲ ਚਾਰਜਸ ਦੇਣੇ ਪੈਣਗੇ ਹਾਂਜੀ ਸਰ ਕੋਈ ਗੱਲ ਨਹੀਂ ਸਰ ਹਾਂਜੀ ਸਰ ਫੋਟੀ ਪ੍ਰਸੈਂਟ ਅਸੀਂ ਐਡਵਾਂਸ ਲਵਾਂਗੇ ਅਤੇ ਬਾਕੀ ਦਾ ਡਿਲੀਵਰੀ ਤੋਂ ਬਾਅਦ ਹੋ ਜਾਵੇਗਾ ਅਡੀਸ਼ਨਲ ਚਾਰਜਸ ਹੋਣਗੇ ਡਿਲੀਵਰੀ ਦੇ ਅਤੇ ਮੋਟਾ ਮੋਟਾ ਜਿਵੇਂ ਤੁਸੀਂ ਲਾ ਲਓ ਹਿਸਾਬ ਪੰਜ ਪੰਜਾਹ ਕਿਲੋ ਤੁਹਾਨੂੰ ਦੋਨੋਂ ਚੀਜ਼ਾਂ ਪੰਜਾਹ ਕਿਲੋ ਪੰਜਾਹ ਕਿਲੋ ਚਾਹੀਦੀਆਂ ਅਤੇ ਇੱਕ ਕਿਲੋ ਪੰਜ ਸੌ ਦੀ ਹੈ ਅਤੇ ਦੂਸਰੀ ਖਜੂਰਾਂ ਇਕ ਕਿਲੋ ਚਾਰ ਸੌ ਦੀਆਂ ਤਾਂ ਤੁਸੀਂ ਜੋੜ ਲਾ ਕੇ ਦੇਖ ਲਓ ਕਿੰਨਾ ਬਣਦਾ ਪੰਜਾਹ ਇਨਟੂ ਪੰਜ ਸੌ ਤੀਹ ਹਜ਼ਾਰ ਹੋ ਗਿਆ ਤੁਹਾਡਾ ਆਪਣਾ ਭੁੱਗੇ ਦਾ ਅਤੇ ਚਾਰ ਵੀਹ ਹਜ਼ਾਰ ਹੋ ਗਿਆ ਤੁਹਾਡਾ ਖਜੂਰਾਂ ਦਾ ਹਾਂਜੀ ਅਤੇ ਉਸ ਤੋਂ ਉੱਪਰ ਜਿਹੜੇ ਹਾਂਜੀ ਡਿਲੀਵਰੀ ਦੇ ਚਾਰਜਸ ਹੋ ਜਾਣਗੇ ਸਾਡੇ ਪੰਜ ਹਜ਼ਾਰ ਨਹੀਂ ਨਹੀਂ ਉਹ ਮੈਂ ਵਿੱਚ ਹੀ ਕਾਊਂਟ ਕਰ ਲਈ ਪਰ ਉਹ ਅਜੇ ਫਾਈਨਲ ਨਹੀਂ ਹੈ ਨਾ ਉਹ ਮੈਨੇਜਰ ਨਾਲ ਗੱਲ ਕਰਕੇ ਫਾਈਨਲ ਹੋ ਪਾਏਗਾ ਹਾਂਜੀ ਸਰ ਹਾਂਜੀ ਸਰ ਚਾਲੀ ਪ੍ਰਸੈਂਟ ਐਡਵਾਂਸ ਪਾ ਦਿਓ ਟੂ ਔਨਲਾਈਨ ਪੇਮੈਂਟ ਨਹੀਂ ਸਰ ਕੋਈ ਗੱਲ ਨਹੀਂ ਓਕੇ ਸਰ ਹਾਂਜੀ ਸਰ ਓਕੇ ਸਰ ਥੈਂਕ ਯੂ ਸੋ ਮੱਚ ਸਰ ਹਾਂਜੀ ਸਰ ਓਕੇ ਓਕ ਸਰ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ